ਕਫ਼ਾਇਤੀ ਆਵਾਜਾਈ ਦੀ ਘਾਟ ਨੇ ਨੇੜਲੇ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਅਸਰ ਦਿਖਾਇਆ ਹੈ ਸਾਨੂੰ ਇਸ ਚੀਜ਼ ਦਾ ਬਹੁਤ ਹੀ ਘਾਟ ਮਹਿਸੂਸ ਹੁੰਦੀ ਹੈ ਅਸੀਂ ਇੱਕ ਕਸਬਿਆਂ ਵਿੱਚ ਰਹਿਣ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਨ ਦੇ ਲਈ ਬਾਹਰ ਸ਼ਹਿਰਾਂ ਦੇ ਵਿੱਚ ਭੇਜਦੇ ਹਾਂ ਤਾਂ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਹੈ ਇਹ ਸਾਨੂੰ ਪਹਿਲਾਂ ਸਾਡੇ ਬੱਚਿਆਂ ਨੂੰ ਬੱਸਾਂ 'ਤੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ ਉੱਥੋਂ ਸਾਡੇ ਬੱਚਿਆਂ ਨੂੰ ਆਟੋ ਲੈ ਕੇ ਅਗਾਂਹ ਸਕੂਲਾਂ ਕਾਲਜਾਂ ਦੇ ਵਿੱਚ ਜਾਣਾ ਪੈਂਦਾ ਹੈ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਅੱਜ ਦੇ ਸਮੇਂ ਦੇ ਵਿੱਚ ਇੱਕ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਬਿਠਾਉਂਦੇ ਹਾਂ ਤਾਂ ਵੀ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੇਕਰ ਅਸੀਂ ਪੜ੍ਹਨ ਵਿੱਚ ਭੇਜ ਪੜ੍ਹਨ ਭੇਜਦੇ ਹਾਂ ਸ਼ਹਿਰਾਂ ਦੇ ਵਿੱਚ ਤਾਂ ਵੀ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਹਨ ਇਸ ਦੇ ਨਾਲ ਸਾਡੇ ਬੱਚਿਆਂ ਦਾ ਸਮਾਂ ਵੀ ਕਾਫ਼ੀ ਜ਼ਿਆਦਾ ਖਰਾਬ ਹੁੰਦਾ ਅਤੇ ਨਾਲ ਹੀ ਸਾਡੇ ਪੈਸੇ ਦੀ ਵੀ ਕਾਫ਼ੀ ਬਰਬਾਦੀ ਹੁੰਦੀ ਅਸੀਂ ਮਿਹਨਤ ਕਰਕੇ ਮਸਾਂ ਹੀ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਸ਼ਹਿਰਾਂ ਦੇ ਵਿੱਚ ਭੇਜਦੇ ਹਾਂ ਸਾਡਾ ਡਬਲ ਡਬਲ ਪੈਸਾ ਲੱਗਦਾ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਅਸੀਂ ਬਹੁਤ ਜ਼ਿਆਦਾ ਦਿੱਕਤ ਮਹਿਸੂਸ ਕਰਦੇ ਹਾਂ ਜੇਕਰ ਅਸੀਂ ਆਪਣੀਆਂ ਬੇਟੀਆਂ ਨੂੰ ਘਰ ਦੇ ਵਿੱਚ ਬਿਠਾਉਂਦੇ ਹਾਂ ਤਾਂ ਵੀ ਨਹੀਂ ਸਰਦਾ ਅੱਜ ਕੱਲ੍ਹ ਨਵੇਂ ਯੁੱਗ ਦੇ ਸਮੇਂ ਦੇ ਵਿੱਚ ਹਰ ਇੱਕ ਬੱਚਾ ਪੜ੍ਹਿਆ ਹੋਣਾ ਚਾਹੀਦਾ ਹੈ ਤਾਂ ਕਿ ਬੱਚਾ ਆਪਣੇ ਪੈਰਾਂ 'ਤੇ ਸਟੈਂਡ ਹੋ ਸਕੇ ਜੇਕਰ ਬੱਚਾ ਆਪਣੇ ਪੈਰਾਂ 'ਤੇ ਖੜ੍ਹਾ ਹੋਊਗਾ ਤਾਂ ਆਪਣੇ ਅੱਗੇ ਵਾਲੀ ਲਾਈਫ ਨੂੰ ਸੈਟ ਕਰ ਸਕਦਾ ਹੈ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਹੀ ਕਸਮਿਆਂ ਦੇ ਵਿੱਚ ਹੀ ਬਿਠਾ ਕੇ ਰੱਖ ਲਾਂਗੇ ਅਤੇ ਸਾਡੀ ਬੇਟੀਆਂ ਦੀ ਬੱਚਿਆਂ ਦੀ ਕੋਈ ਵੀ ਜ਼ਿੰਦਗੀ ਨਹੀਂ ਹੈ ਬੱਚੇ ਬਾਹਰ ਕੱਢਦੇ ਹਾਂ ਅਤੇ ਸਾਨੂੰ ਹੋਰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਹੀਂ ਤਾਂ ਅਸੀਂ ਬੱਚਿਆਂ ਨੂੰ ਨਾ ਹੀ ਘਰ ਵਿੱਚ ਬਿਠਾ ਸਕਦੇ ਹਾਂ ਸਾਡੇ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਹੀ ਇੱਦਾਂ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਕਿ ਸਾਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਡੇ ਬੱਚੇ ਸੌਖੇ ਅਤੇ ਸਖੀਲੇ ਤਰੀਕੇ ਦੇ ਨਾਲ ਪੜ੍ਹ ਲਿਖ ਕੇ ਆਪਣੇ ਕਦਮਾਂ ਉੱਤੇ ਖੜ੍ਹੇ ਹੋ ਸਕਣ